ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਆਪਣੇ ਦਿਮਾਗ ਦੀ ਸੋਚ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਆਸ ਪਾਸ ਦੀ ਚੀਜ਼ਾਂ ਨੂੰ ਦੇਖ ਕੇ ਚੱਲ ਰਿਹਾ ਹੈ ਜੇ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਉਹ ਚੀਜ਼ ਪਹੁੰਚਾਉਣਾ ਚਾਹੁੰਦੇ ਹੋ ਤਾਂ ਚਿੱਤਰਕਾਰੀ ਬਹੁਤ ਹੀ ਲਾਭਕਾਰੀ ਹੋ ਸਕਦੀ ਹੈ ਕਿਉਂਕੀ ਕਈ ਵਾਰ ਇੱਦਾਂ ਹੁੰਦਾ ਹੈ ਕਿ ਆਪਾਂ ਕੋਈ ਚੀਜ਼ ਨੂੰ ਜੋ ਵੀ ਆਪਣੇ ਦਿਮਾਗ ਵਿੱਚ ਜੋ ਵੀ ਚੀਜ਼ ਚੱਲ ਰਹੀ ਹੁੰਦੀ ਆ ਉਸ ਨੂੰ ਬੋਲ ਕੇ ਸਮਝਾਉਣ ਦੀ ਜਗ੍ਹਾ 'ਤੇ ਜੇਕਰ ਅਸੀਂ ਉਸਨੂੰ ਬਣਾ ਕੇ ਦਿਖਾਈਏ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਸਮਝ ਆਉਂਦੀ ਹੈ ਅਤੇ ਜ਼ਿਆਦਾ ਅੱਛੀ ਤਰ੍ਹਾਂ ਨਾਲ ਸਮਝ ਆਉਂਦੀ ਹੈ ਅਤੇ ਕਾਫ਼ੀ ਟਾਈਮ ਤੱਕ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਬਣੀ ਰਹਿੰਦੀ ਹੈ ਇੱਕ ਕਲਾਕਾਰ ਹੋਣ ਦੇ ਵਜੋਂ ਜੇ ਦੇਖਿਆ ਜਾਵੇ ਤਾਂ ਚਿੱਤਰਕਾਰੀ ਕਰਨ ਦੇ ਟਾਈਮ ਅਤੇ ਕਲਪਨਾ ਜੋ ਹੈ ਉਹ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ 'ਤੇ ਪਹੁੰਚਣ ਦੇ ਵਿੱਚ ਉਸਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇੱਕ ਟਾਈਮ 'ਤੇ ਤੁਸੀਂ ਕੁਝ ਹੋਰ ਬਣਾ ਰਹੇ ਓਂ ਬਟ ਜਿਵੇਂ ਹੀ ਤੁਹਾਡੇ ਦਿਲ ਦੀਆਂ ਭਾਵਨਾਵਾਂ ਬਾਹਰ ਆਉਂਦੀਆਂ ਹਨ ਉਹ ਉਸੇ ਤਰ੍ਹਾਂ ਹੀ ਵਕ ਨਿੱਖਰਦੀ ਹੀ ਜਾਂਦੀ ਆ ਉਹ ਚੀਜ਼ ਮਤਲਬ ਕਿ ਜੋ ਚੀਜ ਤੁਸੀਂ ਪਹਿਲਾਂ ਸਟਾਰਟਿੰਗ ਸ਼ੁਰੂ ਦੇ ਵਿੱਚ ਜੋ ਚੀਜ਼ ਤੁਸੀਂ ਸੋਚੀ ਸੀ ਉਹ ਦੇਖਦੇ ਦੇਖਦੇ ਭਾਵਨਾਵਾਂ ਬਾਹਰ ਆਉਂਦੇ ਆਉਂਦੇ ਹੀ ਉਹ ਚੀਜ਼ ਖੂਬਸੂਰਤ ਤੋਂ ਬਹੁਤ ਜ਼ਿਆਦਾ ਖੂਬਸੂਰਤ ਬਣ ਜਾਂਦੀ ਹੈ ਇਸ ਦੀ ਜੇ ਦੇਖਿਆ ਜਾਵੇ ਤਾਂ ਰਸ਼ਨਾਤਮਕਤਾ ਦਾ ਵੀ ਇਸ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਕਿ ਤੁਸੀਂ ਜੋ ਵੀ ਤੁਹਾਡੀ ਜੋ ਕਲਪਨਾ ਹੈ ਉਸਨੂੰ ਤੁਸੀਂ ਆਪਣੇ ਹੁਨਰ ਦੇ ਨਾਲ ਕਿਸ ਤਰ੍ਹਾਂ ਉਸਨੂੰ ਢਾਲ ਰਹੇ ਓਂ ਕੋਰੇ ਕਾਗਜ਼ ਦੇ ਉੱਪਰ ਜੇ ਤੁਹਾਡੇ ਵਿੱਚ ਉਹ ਹੁਨਰ ਹੈ ਤਾਂ ਤੁਸੀਂ ਕੁਛ ਵੀ ਸੋਚ ਕੇ ਜੋ ਵੀ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਹੈ ਉਸਨੂੰ ਸੋਚ ਕੇ ਤੁਸੀਂ ਉਸ ਚੀਜ਼ ਨੂੰ ਕੋਰੇ ਕਾਗਜ਼ ਉਪਰ ਆਸਾਨੀ ਨਾਲ ਟਾਲ ਸਕਦੇ ਹੋ ਉਸ ਤਰ੍ਹਾਂ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਉਸ ਚੀਜ਼ ਨੂੰ ਪਹੁੰਚਾ ਸਕਦੇ ਹੋ ਤਾਂ ਕਿ ਉਹਨਾਂ ਦੇ ਦਿਲ ਅਤੇ ਦਿਮਾਗ ਦੇ ਵਿੱਚ ਉਹ ਬਣੀ ਰਹੇ